ਮੈਂ ਕਲਰਸ ਚੈਨਲ 'ਤੇ ਡਾਂਸ ਇੰਡੀਆ ਡਾਂਸ ਔਰ ਝਲਕ ਦਿਖਲਾਜਾ ਦੇਖਦੀ ਹਾਂ ਉਹ ਡਾਂਸਿੰਗ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਲੋਕ ਨਾਚ ਦਿਖਾਉਂਦੇ ਆ ਕਿਉਂਕਿ ਜਿਹੜੇ ਵੀ ਪਾਰਟੀਸਪੇਟ ਅਲੱਗ ਅਲੱਗ ਸਟੇਟ ਤੋਂ ਆਉਂਦੇ ਨੇ ਉਹਨਾਂ ਦੀਆਂ ਪਰਫੋਰਮੈਂਸ ਹੁੰਦੀਆਂ ਉਹ ਜਰੂਰ ਆਪਣੀ ਸਟੇਟ ਦਾ ਮਤਲਬ ਲੋਕ ਨਾਚ ਸਾਨੂੰ ਦਿਖਾਉਂਦੇ ਨੇ ਔਰ ਉਹ ਵਧੀਆ ਲੱਗਦਾ ਜਿਵੇਂ ਆਪਾਂ ਨੂੰ ਕੁਝ ਕੁ ਬਾਰੇ ਨਹੀਂ ਜਾਣਕਾਰੀ ਹੁੰਦੀ ਉਹਨਾਂ ਦਾ ਡਾਂਸ ਦੇਖ ਕੇ ਜਦੋਂ ਆਪਣੇ ਬਾਰੇ ਦੱਸਦੇ ਆ ਵੀ ਅਸੀਂ ਕਿੱਥੋਂ ਬਿਲੋਂਗ ਕਰਦੇ ਹਾਂ ਸਾਡਾ ਲੋਕ ਨਾਚ ਇਹ ਹੈ ਦੇਖਦੇ ਹਾਂ ਤਾਂ ਸਾਨੂੰ ਬਹੁਤ ਜਾਣਕਾਰੀ ਮਿਲਦੀ ਆ ਔਰ ਵਧੀਆ ਲੱਗਦਾ ਔਰ ਸਿੱਖਣ ਦਾ ਵੀ ਮਨ ਹੁੰਦਾ ਔਰ ਸਿੱਖਦੇ ਵੀ ਹਾਂ ਬਹੁਤ ਵਧੀਆ ਲੱਗਦਾ ਜਿਵੇਂ ਕਿ ਪੰਜਾਬੀ ਦੇ ਵਿੱਚ ਧੀ ਪੰਜਾਬ ਦੀ ਪ੍ਰੋਗਰਾਮ ਚੱਲਦਾ ਉਸਦੇ ਵਿੱਚ ਵੀ ਨਾਚ ਹੁੰਦਾ ਬਲਕਿ ਉਹ ਤਾਂ ਸਾਡੇ ਪੰਜਾਬ ਦੀਆਂ ਧੀਆਂ ਹੀ ਡਾਂਸ ਕਰਦੀਆਂ ਨੇ ਉਹਨਾਂ ਦੇ ਵਿੱਚ ਲੋਕ ਨਾਚ ਕਰਦੀਆਂ ਜਿਵੇਂ ਕਿ ਗਿੱਧਾ ਭੰਗੜਾ ਲੁੱਡੀ ਇਹ ਸਾਡੇ ਪ੍ਰਮੁੱਖ ਲੋਕ ਨਾਚ ਨੇ ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਬਲਕਿ ਉਹ ਵਾਲੇ ਪ੍ਰੋਗਰਾਮ ਤਾਂ ਮੈਂ ਪੰਜਾਬੀ ਪ੍ਰੋਗਰਾਮ ਤਾਂ ਕਦੇ ਵੀ ਮਿਸ ਨਹੀਂ ਕਰਦੀ ਡਾਂਸ ਦੇ ਕਿਉਂਕਿ ਉਹਨਾਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਡਾਂਸ ਦੀ ਇੰਨੀ ਵਰਾਇਟੀ ਹੈ ਜਿਸ ਬਾਰੇ ਆਪਾਂ ਨਹੀਂ ਜਾਣੂ ਹੈਗੇ ਉਹਨਾਂ ਨੂੰ ਦੇਖ ਕੇ ਬਹੁਤ ਕੁਝ ਸਾਨੂੰ ਦੇਖਣ ਨੂੰ ਜਾਨਣ ਨੂੰ ਮਿਲਦਾ ਔਰ ਬੱਚਿਆਂ ਨੂੰ ਵੀ ਦੱਸਦੇ ਆ ਉਸ ਬਾਰੇ ਸਾਡੇ ਤਕਰੀਬਨ ਸਾਡੇ ਘਰ ਦੇ ਵਿੱਚ ਪੰਜਾਬੀ ਲੋਕ ਨਾਚ ਦਾ ਪ੍ਰੋਗਰਾਮ ਜੋ ਵੀ ਟੀਵੀ 'ਤੇ ਆਉਂਦਾ ਸਾਰੇ ਇਕੱਠੇ ਬੈਠ ਕੇ ਦੇਖਦੇ ਹਾਂ ਅਸੀਂ ਜਿਵੇਂ ਕਿ ਮੈਨੂੰ ਡਾਂਸ ਇੰਡੀਆ ਡਾਂਸ ਵੀ ਬਹੁਤ ਵਧੀਆ ਲੱਗਦਾ ਝਲਕ ਦਿਖਲਾ ਜਾ ਵੀ ਬਹੁਤ ਵਧੀਆ ਲੱਗਦਾ ਉਹਦੇ ਵਿੱਚ ਸਟੇਟ ਦੀ ਅਲੱਗ ਅਲੱਗ ਦੀ ਡਰੈਸ ਦੇਖਣ ਨੂੰ ਮਿਲਦੀ ਹੈ ਉਹਨਾਂ ਦੀ ਜੋ ਜੂਲਰੀ ਪਾਈ ਹੁੰਦੀ ਆ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਬਹੁਤ ਵਧੀਆ ਪ੍ਰੋਗਰਾਮ ਲੱਗਦੇ ਨੇ ਇੱਦਾਂ ਦੇ ਮੈਨੂੰ ਬਹੁਤ ਅੱਛੇ ਲੱਗਦੇ ਨੇ